ਹੈਲੋ ਹੈਲੋ ਨਮਸਤੇ ਓਕੇ ਓਕੇ ਮੈਮ ਓਕੇ ਆਪ ਨੇ ਬੀ ਕੌਮ ਸਿੰਪਲ ਕੀ ਹੈ ਔਰ ਹੈਲੋ ਮੈਮ ਪੰਜਾਬੀ ਮੇ ਕੰਫਰਟੇਬਲ ਹੋ ਜਾਂ ਹਿੰਦੀ ਮੇ ਓਕੇ ਠੀਕ ਹੈ ਤੁਸੀਂ ਬੀ ਕੌਮ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਤੋਂ ਓਕੇ ਬੀ ਕੌਮ ਸਿੰਪਲ ਕੀਤੀ ਹੈ ਜਾਂ ਕਿਸੀ ਸਬਜੈਕਟ ਦੇ ਵਿੱਚ ਕੀਤੀ ਹੈ ਸਪੈਸਫਿਕ ਜਿਵੇਂ ਜੀ ਬੀ ਕੌਮ ਹੁੰਦੀ ਹੈ ਆਪਣੀ ਫਾਈਨਾਂਸ ਐਕਾਂਊਟਿੰਗ 'ਚ ਹੁੰਦੀ ਹੈ ਹੋਰ ਕਾਫੀ ਫੀਲਡਸ ਹੁੰਦੀਆਂ ਨੇ ਓਕੇ ਅਤੇ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਓਕੇ ਹਾਂਜੀ ਮੈਮ ਤੁਸੀਂ ਕਿਵੇਂ ਦੀ ਜੋਬ ਕਰਨਾ ਚਾਹੁੰਦੇ ਹੋ ਅੱਗੇ ਇਸ ਫੀਲਡ ਦੇ ਵਿੱਚ ਹੀ ਕੰਮ ਕਰਨਾ ਚਾਹੁੰਦੇ ਹੋ ਆਪਣੀ ਓਕੇ ਮੈਮ ਪਹਿਲਾਂ ਤਾਂ ਤੁਸੀਂ ਜਿਵੇਂ ਤੁਸੀਂ ਫਾਈਨਾਂਸ ਅਕਾਊਂਟਿੰਗ 'ਚ ਕੰਮ ਕੀਤਾ ਹੋਇਆ ਤਾਂ ਤੁਸੀਂ ਗਵਰਮੈਂਟ ਦੀ ਇੱਕ ਉਹ ਹੁੰਦੀ ਹੈ ਜਿਹੜਾ ਆਪਣਾ ਸੈਂਟਰਲ ਬੈਂਕ ਹੈ ਆਪਣੇ ਦੇਸ਼ ਦਾ ਜੋ ਕਿ ਆਰ ਬੀ ਆਈ ਦੇ ਨਾਮ ਤੋਂ ਜਾਣਿਆ ਜਾਂਦਾ ਰਿਜ਼ਰਵ ਬੈਂਕ ਆਫ ਇੰਡੀਆ ਉਹਦੇ ਵਿੱਚ ਤੁਸੀਂ ਇਹਨਾਂ ਦਾ ਇੱਕ ਗ੍ਰੇਡ ਬੀ ਦੀ ਪੋਸਟ ਨਿਕਲਦੀ ਹੈ ਉਹਦਾ ਐਗਜ਼ਾਮ ਦੀ ਤਿਆਰੀ ਕਰਕੇ ਤੁਸੀਂ ਉਹ ਕਰੈਕ ਕਰ ਸਕਦੇ ਹੋ ਅਤੇ ਉਸਦੇ ਨਾਲ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਹੋਰ ਤੁਸੀਂ ਆਪਣੀ ਹਾਂਜੀ ਮੈਮ ਹਾਂਜੀ ਮੈਮ ਮੈਂ ਤੁਹਾਨੂੰ ਕਈ ਕੰਪਨੀਸ ਵੀ ਦੱਸ ਸਕਦੀ ਹਾਂ ਜੋ ਫਾਈਨੈਂਸ ਅਕਾਊਂਟਿੰਗ ਦੇ ਬੱਚਿਆਂ ਨੂੰ ਸਲੈਕਟ ਕਰਦੇ ਨੇ ਅਤੇ ਉਸਦੇ ਵਿੱਚ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਆਪਣੀ ਵਿਪਰੋ ਕੰਪਨੀ ਹੈ ਇੱਕ ਆਪਾਂ ਆਪ ਅਸੀਂ ਤੁਹਾਨੂੰ ਪ੍ਰਾਈਵੇਟ ਕੰਪਨੀਆਂ ਵੀ ਦੱਸ ਸਕਦੇ ਹਾਂ ਜੋ ਫਾਇਨਾਂਸਿੰਗ ਫਾਇਨਾਂਸ ਅਕਾਊਂਟ ਦੇ ਮੈਮ ਕਈ ਬੈਂਕ ਵੀ ਹੁੰਦੇ ਨੇ ਪ੍ਰਾਈਵੇਟ ਬੈਂਕ ਜੋ ਫਾਇਨੈਂਸ ਅਕਾਊਂਟਿੰਗ ਦੇ ਬੱਚਿਆਂ ਨੂੰ ਨੌਕਰੀ ਦਿੰਦੇ ਨੇ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਆਪਣਾ ਐਕਸਿਸ ਬੈਂਕ ਅਤੇ ਜਿਹੜਾ ਆਈ ਸੀ ਆਈ ਸੀ ਬੈਂਕ ਹੈ ਉਹਦੇ ਵਿੱਚ ਵੀ ਤੁਹਾਨੂੰ ਨੌਕਰੀ ਦਵਾ ਸਕਦੀ ਹਾਂ ਜੇ ਤੁਸੀਂ ਉਸਦੇ ਵਿੱਚ ਆਪਣਾ ਇੰਟਰਸਟ ਲੈਂਦੇ ਹੋ ਤਾਂ ਅਸੀਂ ਤੁਹਾਨੂੰ ਉਸਦੇ ਵਿੱਚ ਨੌਕਰੀ ਦਵਾ ਸਕਦੇ ਹਾਂ ਬਾਕੀ ਸਾਡੇ ਕੋਲ ਬਹੁਤ ਸਾਰੀ ਪ੍ਰਾਈਵੇਟ ਕੰਪਨੀ ਵੀ ਹੈ ਫਾਇਨਾਂਸ ਅਕਾਊਂਟਿੰਗ ਦੀਆਂ ਜੋ ਨੌਕਰੀ ਨਹੀਂ ਮੈਮ ਜੇ ਤੁਸੀਂ ਆਪਣੇ ਆਪ ਨੂੰ ਇੱਕ ਹੁਣ ਨਵਾਂ ਨਵਾਂ ਸਮਝਦੇ ਹੋ ਬੱਚਾ ਕਿ ਜਿਸਨੇ ਕਦੇ ਨੌਕਰੀ ਨਹੀਂ ਕੀਤੀ ਤਾਂ ਉਸਦਾ ਕਈ ਵਾਰ ਇੰਟਰਵਿਊ ਨਹੀਂ ਵੀ ਹੁੰਦਾ ਕਈ ਵਾਰੀ ਇੰਟਰਵਿਊ ਵੀ ਲਿੱਤਾ ਜਾ ਸਕਦਾ ਦੇਖੋ ਮੈਮ ਜਿਵੇਂ ਤੁਸੀਂ ਤੁਹਾਡੇ ਕੋਲ ਕੋਈ ਵੀ ਕਿਸੇ ਵੀ ਤਰੀਕੇ ਦਾ ਐਕਸਪੀਰੀਅੰਸ ਨਹੀਂ ਹੈ ਜਿਹਦੇ ਨਾਲ ਤੁਸੀਂ ਕਦੇ ਕੰਮ ਕੀਤਾ ਹੋਵੇ ਤਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਪੰਦਰ੍ਹਾਂ ਤੋਂ ਵੀਹ ਹਜ਼ਾਰ ਦੇ ਵਿੱਚ ਤੁਸੀਂ ਉਮੀਦ ਰੱਖ ਸਕਦੇ ਹੋ ਕਿ ਤੁਹਾਨੂੰ ਇੰਨਾ ਕੁ ਪੈਸੇ ਮਿਲ ਸਕਦੇ ਹੈ ਕੋਈ ਗੱਲ ਨਹੀਂ ਮੈਮ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ ਤਿੰਨ ਮਹੀਨੇ ਦਾ ਤਾਂ ਅਸੀਂ ਤੁਹਾਨੂੰ ਨੌਕਰੀ ਦੇ ਸਕਦੇ ਹਾਂ ਫੇਰ ਤਾਂ ਤੁਹਾਡੀ ਜਿਹੜੀ ਸੈ ਤਨਖਾਹ ਹੋਏਗੀ ਉਹ ਵੀ ਬਹੁਤ ਜ਼ਿਆਦਾ ਵੀਹ ਤੋਂ ਪੱਚੀ ਹਜ਼ਾਰ ਤੱਕ ਵੀ ਤੁਸੀਂ ਉਮੀਦ ਰੱਖ ਸਕਦੇ ਹੋ ਕਿ ਤੁਹਾਨੂੰ ਮਿਲ ਜੇਗੀ ਮੈਮ ਰੈਗੂਲਰ ਟਾਈਮਿੰਗ ਨੌ ਤੋਂ ਪੰਜ ਜੋ ਹਰ ਬੈਂਕ ਔਰ ਕਿਸੀ ਵੀ ਔਫਿਸ ਦੀ ਹੁੰਦੀ ਹੈ ਹਾਂਜੀ ਮੈਮ ਸਾਡੇ ਕੋਲ ਐਵੇਂ ਦੇ ਕਈ ਨੌਕਰੀਆਂ ਪਈਆਂ ਨੇ ਜੋ ਕਪੂਰਥਲਾ ਦੇ ਪੂਰੇ ਡਿਸਟ੍ਰਿਕਟ ਨੇ ਉਹਦੇ ਵਿੱਚ ਅਸੀਂ ਕੋਈ ਵੀ ਕਿਸੀ ਬੈਂਕ ਦੇ ਵਿੱਚ ਨੌਕਰੀ ਦਵਾ ਸਕਦੇ ਹਾਂ ਜਦੋਂ ਮੈਮ ਹੋਇਆ ਕਿ ਹਾਂ ਤੁਸੀਂ ਹੁਣ ਨੌਕਰੀ ਕਰਨੀ ਹੈ ਤਾਂ ਤੁਸੀਂ ਸਾਨੂੰ ਇਸ ਨੰਬਰ ਦੇ ਉੱਤੇ ਦੁਬਾਰਾ ਕੌਲ ਕਰਕੇ ਪੁੱਛ ਸਕਦੇ ਹੋ ਅਤੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੱਸਣ ਦੇ ਵਿੱਚ ਓਕੇ ਮੈਮ